ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਬੋਲੋ ਜੀ ਹੁਕਮ ਕਰੋ ਜੀ ਅੱਛਾ ਜੀ ਓਕੇ ਅੱਛਾ ਤੁਸੀਂ ਹੁਣ ਆ ਸਕਦੇ ਹੋ ਜੀ ਸ਼ਹੀਦੀ ਜੋੜ ਮੇਲਾ ਜਿਹੜਾ ਸਲਾਨਾ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਹੈ ਗਿਆਰ੍ਹਾਂ ਬਾਰ੍ਹਾਂ ਤੇਰ੍ਹਾਂ ਤੋਂ ਅਤੇ ਛੱਬੀ ਸਤਾਈ ਅਠਾਈ ਦਸੰਬਰ ਨੂੰ ਜਿਹੜੀ ਸਲਾਨਾ ਸਭਾ ਇਹ ਸ਼ਹੀਦੀ ਜੋੜ ਮੇਲ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਜੀ ਹਰੇਕ ਸਾਲ ਅਤੇ ਰਹਿੰਦੀ ਦੁਨੀਆਂ ਤੱਕ ਮਨਾਇਆ ਜਾਵੇਗਾ ਅਤੇ ਇਹ ਇਹ ਜਿਹੜਾ ਜੀ ਪਹਿਲਾਂ ਉਰੇ ਫਤਿਹਗੜ੍ਹ ਸਾਹਿਬ ਗੁਰਦੁਆਰਾ ਨਾਲ ਹੀ ਉਹਦੇ ਉੱਤੇ ਮਾਤਾ ਗੁਜਰ ਕੌਰ ਜੀ ਦਾ ਠੰਡੇ ਬੁਰਜ ਦਾ ਗੁਰਦੁਆਰਾ ਸਾਹਿਬ ਆ ਅਤੇ ਫਿਰ ਇੱਧਰ ਜੋਤੀ ਸਰੂਪ ਸਾਹਿਬ ਆ ਜੀ ਪਹਿਲਾਂ ਤੁਸੀਂ ਆ ਕੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦਰਸ਼ਨ ਕਰੋ ਅਤੇ ਠੰਡੇ ਬੁਰਜ ਕਰੋ ਫਿਰ ਇੱਧਰ ਮਾਤਾ ਗੁਜਰੀ ਜੀ ਦਾ ਦਾ ਗੁਰਦੁਆਰਾ ਠੰਡਾ ਬੁਰਜ ਉੱਥੇ ਜਾਓ ਉਹ ਤੋਂ ਬਾਅਦ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਆਓ ਉੱਥੇ ਆ ਕੇ ਦਰਸ਼ਨ ਕਰੋ ਉਸ ਤੋਂ ਬਾਅਦ ਇੱਕ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਗੁਰਦੁਆਰਾ ਜਿਹਨਾਂ ਨੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਇਆ ਸੀ ਜੀ ਉੱਥੇ ਗਲਾਸ ਵੀ ਪਏ ਨੇ ਉਹੀ ਸਾਹਿਬਜ਼ਾਦਿਆਂ ਵਾਲੇ ਉਹਨਾਂ ਦੇ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਇਹ ਜਿਹੜੀ ਦੀਵਾਨ ਟੋਡਰ ਮਲ ਜੀ ਦੀ ਹਵੇਲੀ ਆ ਜੀ ਉਹ ਰੇਲਵੇ ਲਾਈਨ ਪਾਰ ਕਰਕੇ ਡੇਢ ਜਾਂ ਦੋ ਕਿਲੋਮੀਟਰ 'ਤੇ ਮਿਨੀਮਮ ਦੂਰੀ 'ਤੇ ਆ ਤੁਸੀਂ ਪੈਦਲ ਵੀ ਜਾ ਸਕਦੇ ਹੋ ਅਤੇ ਬਾਈ ਕਾਰ ਵੀ ਜਾ ਸਕਦੇ ਹੋ ਉਹ ਵਿਰਾਸਤੀ ਹਵੇਲੀ ਆ ਦੀਵਾਨ ਟੋਡਰ ਮਲ ਜੀ ਦੀ ਅਤੇ ਉੱਥੇ ਹੁਣ ਕਾਰ ਸੇਵਾ ਹਲੇ ਚੱਲ ਰਹੀ ਹੈ ਜੀ ਉਹ ਵੀ ਕੰਮ ਚੱਲ ਰਿਹਾ ਉਥੇ ਵੀ ਬਹੁਤ ਸੰਗਤ ਜਾਂਦੀ ਹੈ ਦੁਨੀਆਂ ਜਾਂਦੀ ਦੇਖਣ ਜਾਂਦੀ ਆ ਅਤੇ ਨਾਲ ਹੀ ਇੱਥੇ ਇਕ ਰੋਜਾ ਸਰੀਫ਼ ਵੀ ਹੈ ਜੀ ਅਤੇ ਇੱਥੇ ਜਿਹੜਾ ਰਹਿਣ ਸਹਿਣ ਦਾ ਪ੍ਰਬੰਧ ਆ ਇਹ ਸਾਰਾ ਹੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵੱਲੋਂ ਕੀਤਾ ਜਾਂਦਾ ਜੀ ਪ੍ਰੋਪਰ ਤੌਰ 'ਤੇ ਕਿਸੇ ਕਿਸਮ ਦੀ ਕੋਈ ਦਿੱਕਤ ਕੋਈ ਪਰੇਸ਼ਾਨੀ ਅਨੇਕਾਂ ਪ੍ਰਕਾ ਪ੍ਰਕਾਰ ਦੇ ਉਰੇ ਲੰਗਰ ਲੱਗੇ ਹੁੰਦੇ ਆ ਕਿਸੇ ਵੀ ਕਿਸਮ ਦੀ ਕੋਈ ਵੀ ਦਿੱਕਤ ਜਾਂ ਪਰੇਸ਼ਾਨੀ ਵਾਲੀ ਕੋਈ ਵੀ ਇੱਕ ਪ੍ਰਸੈਂਟ ਗੱਲ ਨਹੀਂ ਹੈਗੀ ਜੀ ਜਿਹੜਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਜੋਤੀ ਸਰੂਪ ਸਾਹਿਬ ਆ ਉਹਦੀ ਬੈਕ ਸਾਈਡ 'ਤੇ ਵੀ ਤੁਸੀਂ ਪੈਦਲ ਵੀ ਜਾ ਸਕਦੇ ਹੋ ਦੋ ਕਿਲੋਮੀਟਰ ਦੀ ਦੂਰੀ 'ਚ ਹੈ ਬਾਏ ਕਾਰ ਵੀ ਜਾ ਸਕਦੇ ਹੋ ਮਤਲਬ ਜਿੱਥੇ ਵੀ ਤੁਸੀਂ ਜਾਣਾ ਬਾਏ ਰੋਡ ਮਤਲਬ ਕਾਰ ਵੀ ਜਾ ਸਕਦੇ ਹੋ ਅਤੇ ਪੈਦਲ ਵੀ ਜਾ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਅਜਿਹੀ ਅਤੇ ਜਿਹੜੇ ਪੁਖਤਾ ਪ੍ਰਬੰਧ ਹੁੰਦੇ ਆ ਸਾਰੇ ਮੈਨੇਜਮੈਂਟ ਵੱਲੋਂ ਕੀਤੇ ਜਾਂਦੇ ਆ ਅਤੇ ਪ੍ਰਸ਼ਾਸਨ ਬਹੁਤ ਸਾਥ ਦਿੰਦਾ ਮਤਲਬ ਅਲੱਗ ਅਲੱਗ ਤਰ੍ਹਾਂ ਦੇ ਲ ਲਿਖੇ ਹੁੰਦੇ ਆ ਵੀ ਇੱਧਰ ਰਾਈਟ ਜਾਓ ਖੱਬੇ ਜਾਓ ਸੱਜੇ ਜਾਓ ਪ੍ਰੋਪਰ ਐਨ ਪੂਰੀ ਤੁਹਾਨੂੰ ਜਾਣਕਾਰੀ ਹੋਏਗੀ ਜੀ ਸਾਰਾ ਕੁਛ ਹੋਏਗਾ ਹਾਂਜੀ ਓਕੇ ਜੀ ਸਤਿ ਸ਼੍ਰੀ ਅਕਾਲ